ਹੈਲੋ ਹੈਲੋ ਹਾਂਜੀ ਮੈਮ

ਹਾਂਜੀ ਹਾਂਜੀ ਬਰਨਾਲੇ ਜੀ ਬਰਨਾਲੇ ਆ ਜਿਓ ਜੀ ਵਧੀਆ ਅਤੇ ਤੁਸੀਂ ਬਾਏ ਟਰੇਨ ਆਉਂਗੇ ਕਿ ਬਾਏ ਰੋਡ ਜੀ ਤੁਸੀਂ ਜੇ ਤਾਂ ਆਏ ਬਾਏ ਟਰੇਨ ਜੀ ਬਾਏ ਟਰੇਨ 'ਤੇ ਤੁਹਾਨੂੰ ਲੰਮਾ ਪੈ ਜੁਗਾ ਕਿਉਂਕਿ ਪਹਿਲਾਂ ਤੁਹਾਨੂੰ ਲੁਧਿਆਣੇ ਜਾਣਾ ਪਊ ਲੁਧਿਆਣੇ ਤੋਂ ਬਰਨਾਲਾ ਆਉਣਾ ਪਊ ਅਤੇ ਆਪਣੇ ਤੁਸੀਂ ਪਟਿਆਲੇ ਤੋਂ ਆਉਣਾ ਅਤੇ ਤੁਸੀਂ ਐਂ ਬਾਏ ਰੋਡ ਆਇਓ ਅਤੇ ਆਪਦਾ ਆਪਦੀ ਗੱਡੀ 'ਤੇ ਆਪਣੇ ਸਾਧਨ 'ਤੇ ਆਉਂਗੇ ਤਾਂ ਵਧੀਆ ਜੀ ਵੈਸੇ ਬੱਸ ਵਗੈਰਾ ਵੀ ਆਪਣੇ ਆਉਂਦੀ ਤਾਂ ਸਿੱਧੀ ਹੈ ਅਤੇ ਜੇ ਜੇ ਤੁਸੀਂ ਆਪਦੇ ਸਾਧਨ 'ਤੇ ਆਉਂਗੇ ਤਾਂ ਜ਼ਿਆਦਾ ਵਧੀਆ ਕਿਉਂਕਿ ਇੱਥੇ ਥੋੜ੍ਹਾ ਕੋਸਟਲੀ ਪੈ ਜੂਗਾ ਤੁਹਾਨੂੰ ਜੇ ਇੱਥੇ ਆ ਕੇ ਆਪਾਂ ਆਪਣਾ ਰੈਂਟ 'ਤੇ ਗੱਡੀ ਵਗੈਰਾ ਲਵਾਂਗੇ ਤਾਂ ਅਤੇ ਇੰਨਾ ਜ਼ਿਆਦਾ ਦੂਰ ਆਉਣ ਵਾਸਤੇ ਤੁਹਾਨੂੰ ਮੰਨ ਕੇ ਚੱਲੋ ਵੀ ਨੱ ਅੱਸੀ ਨੱਬੇ ਕਿਲੋਮੀਟਰ ਰਹਿ ਜਾਂਦਾ ਹੈਗਾ ਕੋਈ ਇੰਨਾ ਜ਼ਿਆਦਾ ਵੀ ਨਹੀਂ ਪੈਣਾ ਅਤੇ ਘੁੰਮਣ ਵਾਸਤੇ ਇੱਥੇ ਹੈਗੀਆਂ ਬਹੁਤ ਸਾਰੀਆਂ ਜਗ੍ਹਾਵਾਂ ਜਗ੍ਹਾ ਹੈਗੀਆਂ ਜੀ ਜਿਵੇਂ ਇੱਥੇ ਆਪਣੇ ਇੱਕ ਤਾਂ ਮੰਨ ਕੇ ਚੱਲੋ ਵੀ ਅੜੀਸਰ ਗੁਰਦੁਆਰਾ ਸਾਹਿਬ ਹੈਗੇ ਐਗੇ ਅਤੇ ਇੱਥੇ ਬਹੁਤ ਮੰਨਤਾ ਹੁੰਦੀ ਹੈ ਪੂਰੀਆਂ ਵੀ ਹੁੰਦੀਆਂ ਸੁੱਖਾਂ ਵਗੈਰਾ ਜੀ ਅਤੇ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਵੀ ਹੈ ਸੰਡੇ ਨੂੰ ਥੋੜ੍ਹਾ ਜ਼ਿਆਦਾ ਹੁੰਦਾ ਗਾ ਜੇ ਤੁਸੀਂ ਆਉਣਾ ਹੋਇਆ ਘੁੰਮਣ ਨੂੰ ਅਤੇ ਕੋਈ ਸ਼ਰਧਾ ਵਗੈਰਾ ਹੁੰਦੀ ਤਾਂ ਸ਼ੁੱਕਰਵਾਰ ਨੂੰ ਦੇਖ ਲਿਓ ਸ਼ੁੱਕਰਵਾਰ ਵਗੈਰਾ ਆ ਜਿਓ ਅਤੇ ਮੌਲ ਹੈਗੇ ਗੇ ਆਪਣੇ ਹਾਂਜੀ ਹਾਂਜੀ ਇੱਥੇ ਆਪਣਾ ਦਸਵੇਂ ਪਾਤਸ਼ਾਹ ਜੀ ਆਏ ਸੀਗੇ ਅਤੇ ਆਪਣੇ ਘੋੜੇ 'ਤੇ ਆਏ ਸੀਗੇ ਅਤੇ ਉਹਨਾਂ ਨੂੰ ਵੀ ਉਹਨਾਂ ਦਾ ਜਦੋਂ ਇੱਥੇ ਤੰਬਾਕੂ ਦਾ ਖੇਤ ਸੀਗਾ ਅਤੇ ਉਹਨਾਂ ਦਾ ਘੋੜਾ ਇੱਥੋਂ ਅੜੀ ਸਾਹਿਬ ਸਾਹਿਬ ਜਦੋਂ ਇੱਥੋਂ ਦੀ ਲੰਘਣ ਲੱਗੇ ਤਾਂ ਘੋੜਾ ਲੰਘਿਆ ਨਹੀਂ ਉਹਨਾਂ ਦਾ ਅਤੇ ਉਹ ਘੋੜਾ ਇੱਥੇ ਅੜੀ ਕਰਨ ਲੱਗ ਗਿਆ ਸੀ ਅਤੇ ਤੰਬਾਕੂ ਦੇ ਖੇਤ ਵਿੱਚ ਦੀ ਲੰਘਿਆ ਨਹੀਂ ਅਤੇ ਬਸ ਉੱਥੋਂ ਅੜੀ ਸਾਹਿਬ ਫਿਰ ਗ ਦਸਵੇਂ ਪਾਤਸ਼ਾਹ ਜੀ ਇੱਥੇ ਰੁਕੇ ਸੀ ਉਹਨਾਂ ਨੇ ਬਚਨ ਕੀਤੇ ਸੀ ਅਤੇ ਉਦੋਂ ਤੋਂ ਇਹਨਾਂ ਦਾ ਨਾਮ ਗੁਰਦੁਆਰਾ ਸਾਹਿਬ ਦਾ ਅੜੀਸਰ ਸਾਹਿਬ ਗੁਰਦੁਆਰਾ ਪੈ ਗਿਆ ਸੀਗਾ ਕਾਫੀ ਕਾਫੀ ਬਹੁਤ ਦੂਰ ਦੂਰ ਤੱਕ ਮਸ਼ਹੂਰ ਆ ਜੀ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਹੈ ਖਾਸ ਕਰਕੇ ਜਿਨ੍ਹਾਂ ਦੇ ਵੀਜੇ ਵਗੈਰਾ ਨਹੀਂ ਲੱਗਦੇ ਜਹਾਜ਼ ਵਗੈਰਾ ਚੜ੍ਹਾਉਂਦੇ ਆ ਹੈ ਨਾ ਬਹੁਤ ਚੜ੍ਹਾਵਾ ਚੜ੍ਹਦਾ ਅਤੇ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਆ ਪੇਪਰ ਵਗੈਰਾ ਕਲੀਅਰ ਹੁੰਦੇ ਹੈਗੇ ਅਤੇ ਹਾਂ ਮੌਲ ਵਗੈਰਾ ਹੈਗੇ ਆ ਅਤੇ ਆਪਣੇ ਕਿਲ੍ਹਾ ਹੈਗਾ ਗਾ ਜੀ ਅਤੇ ਦੋ ਭਰਾਵਾਂ ਦਾ ਸਾਂਝਾ ਢਾਬਾ ਹੈਗਾ ਜੀ ਉੱਥੇ ਬਹੁਤ ਵਧੀਆ ਟੇਸਟੀ ਖਾਣਾ ਮਿਲਦਾ ਗਾ ਅਤੇ ਜੋ ਕੋਈ ਵੀ ਇੱਥੋਂ ਦੀ ਰੋਡ ਦੇ ਉੱਤੇ ਹੀ ਆ ਜਦੋਂ ਵੀ ਕੋਈ ਲੰਘਦਾ ਤਾਂ ਇਹ ਨਹੀਂ ਹੈਗਾ ਹੈ ਨਾ ਵੀ ਰੋਕੇ ਬਗੈਰ ਉੱਥੋਂ ਜਾਵੇ ਹਾਂ ਬਹੁਤ ਵਧੀਆ ਆ ਜਿਓ ਕੋਈ ਗੱਲ ਨਹੀਂ ਘੁੰਮਾ ਦਿਆਂਗੇ ਜੀ ਤੁਹਾਡਾ ਕੋਈ ਐਨਾ ਖਰਚਾ ਵੀ ਨਹੀਂ ਹੋਣਾ ਵਧੀਆ ਘੁੰਮਾ ਦਿਆਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਹਾਂਜੀ ਓਕੇ ਜੀ